ਸਾਡੇ ਇਲਾਕੇ ਦੇ ਵਿੱਚ ਮਛੇਰਿਆਂ ਦੀਆਂ ਕੋਈ ਖਾਸ ਜਾਤਾਂ ਨਹੀਂ ਪਾਈਆਂ ਜਾਂਦੀਆਂ ਕਿਉਂਕਿ ਜ਼ਿਆਦਾਤਰ ਮਛੇਰਿਆਂ ਦੀਆਂ ਲਾ ਜਾਤਾਂ ਤਾਮਿਲਨਾਡੂ ਕੇਰਲਾ ਜਿਹੜੇ ਸਮੁੰਦਰੀ ਕਿਨਾਰੇ ਨੇ ਓਨ੍ਹਾਂ ਦੀ ਕਿਨਾਰੇ ਨਾਲ ਹਿੱਸੇ ਨਾਲ ਜਿਹੜੀ ਧਰਤੀ ਦੇ ਓਹਨਾਂ ਵਿੱਚ ਜ਼ਿਆਦਾਤਰ ਮਛੇਰੇ ਰਹਿੰਦੇ ਨੇ ਉੱਥੇ ਜ਼ਿਆਦਾਤਰ ਓਹਨਾਂ ਦੀਆਂ ਜਾਤਾਂ ਪਾਇਆਂ ਜਾਂਦੀਆਂ ਨੇ ਅਤੇ ਇੱਕ ਸਮਾਜ ਦੇ ਵਿੱਚ ਅਸੀਂ ਏਥੀਕਲੀ ਜੋ ਹੁੰਦਾ ਹੈ ਓਹਦੇ ਮੁਤਾਬਕ ਇੱਕ ਦੂਜੇ ਦੀ ਮਦਦਗਾਰ ਬਣ ਕੇ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਵਿੱਚ ਸਾਂਝੇ ਹੋ ਕੇ ਤਿਉਹਾਰਾਂ ਵਿੱਚ ਸ਼ਰੀਕ ਹੋ ਕੇ ਅਸੀਂ ਰਹਿੰਦੇ ਹਾਂ ਭਾਈਚਾਰਾ ਬਣਾ ਕੇ ਅਤੇ ਮੱਛੀਆਂ ਫੜਨ ਵਾਲੇ ਜਿਹੜੇ ਭਾਈਚਾਰਿਆਂ ਦੇ ਤਿਉਹਾਰ ਨੇ ਓਹ ਸਾਰੇ ਜੋ ਸਾਰਿਆਂ ਦੇ ਕੋਮਨ ਹੁੰਦੇ ਨੇ ਓਹਨਾਂ ਤਿਉਹਾਰਾਂ ਨੂੰ ਹੀ ਓਹ ਮਨਾਉਂਦੇ ਨੇ ਜ਼ਿਆਦਾਤਰ ਓਹਨਾਂ ਦੇ ਕੋਈ ਆਪਣੇ ਵੱਖਰੇ ਜਿਹੜੇ ਤਿਉਹਾਰ ਨੇ ਓਹ ਨਹੀਂ ਰੱਖੇ ਹੁੰਦੇ